ਹੈਲੋ ਸਰ ਗੁਡ ਮੋਰਨਿੰਗ ਮੈ ਮਮਤਾ ਰਾਣੀ ਪਿੰਡ ਘੁੱਦਾ ਤੋਂ ਬੋਲ ਰਹੀ ਹਾਂ ਤੁਸੀਂ ਐਮਾਜ਼ੋਨ ਕੰਪਨੀ ਤੋਂ ਬੋਲ ਰਹੇ ਹੋ ਸਰ ਇਸ ਤਰ੍ਹਾਂ ਸੀ ਜੀ ਮੈਨੂੰ ਨਾ ਲੈਪਟੋਪ ਦੀ ਜ਼ਰੂਰਤ ਸੀ ਆਪਣੀ ਬੇਟੀ ਵਾਸਤੇ ਮੇਰੀ ਬੇਟੀ ਸਟਡੀ ਕਰ ਰਹੀ ਆ ਉਹਨੂੰ ਸਟਡੀ ਵਾਸਤੇ ਲੈਪਟੋਪ ਦੀ ਜ਼ਰੂਰਤ ਸੀ ਮੈਂ ਤੁਹਾਡੀ ਏਜੰਸੀ ਤੋਂ ਲੈਪਟੋਪ ਔਰਡਰ ਕੀਤਾ ਸੀ ਸਰ ਲੈਪਟੋਪ ਦੀ ਡੇਟ ਸੀਗੀ ਵੀ ਛੇ ਛੇ ਦਿਨਾਂ ਦੇ ਵਿੱਚ ਵਿੱਚ ਤੁਹਾਡਾ ਲੈਪਟੋਪ ਤੁਹਾਡੇ ਔਰਡਰ 'ਤੇ ਪਹੁੰਚ ਜਾਏਗਾ ਸਰ ਮੇਰਾ ਲੈਪਟੋਪ ਪੰਜ ਦਿਨਾਂ ਦਾ ਔਰਡਰ 'ਤੇ ਮੇਰੇ ਕੋਲ ਘਰ ਪਹੁੰਚ ਚੁੱਕਿਆ ਹੈ ਸਰ ਬਜ਼ਾਰ ਵਿੱਚ ਮੈਂ ਉਸ ਲੈਪਟੋਪ ਦੀ ਕੀਮਤ ਪਤਾ ਕੀਤੀ ਸੀਗੀ ਉਸ ਲੈਪਟੋਪ ਦੀ ਕੀਮਤ ਕਾਫੀ ਜ਼ਿਆਦਾ ਸੀ ਪਰ ਐਮੋਜ਼ੋਨ ਕੰਪਨੀ ਵਿੱਚੋਂ ਉਸ ਲੈਪਟੋਪ ਦੀ ਕੀਮਤ ਕਾਫੀ ਘੱਟ ਸੀ ਬਜ਼ਾਰ ਨਾਲੋਂ ਕਾਫੀ ਫਰਕ ਸੀ ਸਰ ਮੇਰੇ ਕੋਲ ਮਾਰਕੀਟ ਜਾਣ ਦਾ ਸਮਾਂ ਵੀ ਨਹੀਂ ਸੀਗਾ ਬਟ ਮੇਰੇ ਕੋਲ ਸਮਾਂ ਵੀ ਬਚਿਆ ਅਤੇ ਮੇਰੇ ਪੈਸੇ ਵੀ ਬਚੇ ਤੁਹਾਡੀ ਕੰਪਨੀ ਦਾ ਔਰਡਰ ਜਦੋਂ ਮੈਂ ਕੀਤਾ ਮੈਨੂੰ ਲੈਪਟੋਪ ਮਿਲ ਚੁੱਕਿਆ ਹੈ ਲੈਪਟੋਪ ਛੇ ਦਿਨਾਂ ਦੀ ਬਜਾਏ ਮੈਨੂੰ ਪੰਜ ਦਿਨਾਂ ਦੇ ਵਿੱਚ ਮੇਰੇ ਘਰ ਆ ਚੁੱਕਿਆ ਹੈ ਸਰ ਲੈਪਟੋਪ ਬਹੁਤ ਜ਼ਿਆਦਾ ਵਧੀਆ ਸੀਗਾ ਮੇਰੀ ਬੇਟੀ ਲੈਪਟੋਪ ਲੈ ਕੇ ਬਹੁਤ ਖੁਸ਼ ਹੋਈ ਉਹਦੇ ਸਾਰੇ ਫੀਚਰ ਨਿਊ ਸੀਗੇ ਪੈਸੇ ਵੀ ਬਜ਼ਾਰ ਨਾਲੋਂ ਘੱਟ ਲੱਗੇ ਸਮਾਂ ਵੀ ਘੱਟ ਲੱਗਿਆ ਸਾਨੂੰ ਬਹੁਤ ਖੁਸ਼ੀ ਹੋਈ ਅਸੀਂ ਤੁਹਾਡੀ ਕੰਪਨੀ ਦਾ ਬਹੁਤ ਬਹੁਤ ਜ਼ਿਆਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਕਿਉਂਕਿ ਤੁਸੀਂ ਸਾਨੂੰ ਸਮੇਂ ਤੋਂ ਪਹਿਲਾਂ ਲੈਪਟੋਪ ਵੀ ਦੇਤਾ ਸਾਡੇ ਪੈਸੇ ਦੀ ਬਚਤ ਵੀ ਹੋ ਗਈ ਨਾ ਹੀ ਤਾਂ ਮੇਰੇ ਕੋਲ ਮਾਰਕੀਟ ਜਾਣ ਦਾ ਟਾਈਮ ਸੀਗਾ ਅਤੇ ਨਾਲੇ ਮੇਰੇ ਪੈਸੇ ਵੀ ਬਚ ਗਏ ਮੇਰੇ ਬੱਚੇ ਵੀ ਖੁਸ਼ ਹੋ ਗਏ ਮੇਰੀ ਬੇਟੀ ਬਹੁਤ ਖੁਸ਼ ਹੋਈ ਲੈਪਟਾਪ ਦੇਖ ਕੇ ਨਿਊ ਫੀਚਰ ਦੇਖ ਕੇ ਸਾਰੇ ਬੱਚੇ ਖੁਸ਼ ਹੋ ਗਏ ਉਹਨਾਂ ਨੂੰ ਆਪਣਾ ਲੈਪਟਾਪ ਮਿਲ ਗਿਆ ਸਰ ਮੈਨੂੰ ਵੀ ਬਹੁਤ ਖੁਸ਼ੀ ਹੋਈ ਤੁਹਾਡੀ ਕੰਪਨੀ ਬੜੀ ਵਧੀਆ ਕੰਪਨੀ ਹੈ ਸਰ ਤੁਹਾਡੀ ਕੰਪਨੀ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੇ ਹਾਂ ਅੱਗੇ ਤੋਂ ਵੀ ਅਸੀਂ ਤੁਹਾਡੀ ਕੰਪਨੀ ਨੂੰ ਕਾਫੀ ਔਰਡਰ ਪਾਵਾਂਗੇ ਇਸ ਲਈ ਥੈਂਕ ਯੂ ਸਰ ਬਹੁਤ ਬਹੁਤ ਸ਼ੁਕਰੀਆ